ਟੈਕਨੋਲੋਜੀ ਨੇ ਆਧੁਨਿਕ ਸੰਸਾਰ ਵਿੱਚ ਲੋਕਾਂ ਲਈ ਬਹੁਤ ਸਾਰੇ ਤਕਨੀਕੀ ਹੁਨਰ ਉਜਾਗਰ ਕੀਤੇ ਹਨ ਜਿੱਦਾਂ ਕਿ ਈਮੇਲ ਹੋ ਗਈ ਵੀਡੀਓ ਕਾਨਫਰਸਿੰਗ ਹੋ ਗਈ ਸਰਚ ਇੰਜਨ ਹੋ ਗਿਆ ਜੂਮ ਮੀਟਿੰਗ ਹੋ ਗਈ ਅਤੇ ਜੇ ਗੱਲ ਕਰੀਏ ਅੱਜ ਦੇ ਕੋਆਪਰੇਟਿਵ ਵਰਲਡ ਦੀ ਤਾਂ ਇਹਨਾਂ ਵਿੱਚ ਇਹ ਸਭ ਚੀਜ਼ਾਂ ਦੀ ਬਹੁਤ ਹੀ ਵਰਤੋਂ ਹੁੰਦੀ ਹੈ ਅਤੇ ਵੱਡੇ ਵੱਡੇ ਬਿਜ਼ਨਸ ਕੰਪਨੀਆਂ ਵੀ ਉਹਨਾਂ ਲੋਕਾਂ ਨੂੰ ਹੀ ਹਾਇਰ ਕਰਦੀਆਂ ਹਨ ਜਿਹਨਾਂ ਨੂੰ ਇਹਨਾਂ ਸਭ ਬਾਰੇ ਜਾਣਕਾਰੀ ਹੋਵੇ ਜਿਹੜੀ ਈਮੇਲ ਹੈ ਈਮੇਲ ਦੀ ਤਾਂ ਬਹੁਤ ਹੀ ਵਰਤੋਂ ਹੁੰਦੀ ਹੈ ਈਮੇਲ ਵਿੱਚ ਅਸੀਂ ਪਹਿਲੇ ਸਭ ਤੋਂ ਪਹਿਲੇ ਆਈ ਡੀ ਬਣਦੀ ਹੈ ਜਿਸ ਵਿੱਚ ਲੋਕ ਇੱਕ ਦੂਸਰੇ ਨੂੰ ਆਪਣੇ ਸੰਦੇਸ਼ ਭੇਜਦੇ ਹਨ ਅਤੇ ਕੁਝ ਨਾਲ ਫਾਈਲਾਂ ਵੀ ਅਟੈਚ ਕਰਕੇ ਭੇਜਦੇ ਹਨ ਅਤੇ ਈਮੇਲ ਦੇ ਥਰੂ ਹੀ ਜਿਸ ਨੂੰ ਅਸੀਂ ਆਪਣਾ ਸੰਦੇਸ਼ ਭੇਜਿਆ ਹੈ ਉਹ ਦੁਬਾਰਾ ਸਾਨੂੰ ਜਵਾਬ ਵੀ ਈਮੇਲ ਦੇ ਥਰੂ ਹੀ ਦਿੰਦਾ ਹੈ ਅਤੇ ਜਿਹੜੀ ਵੀਡੀਓ ਕਾਨਫਰਸਿੰਗ ਹੈ ਵੀਡੀਓ ਕਾਨਫਰਸਿੰਗ ਵੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਜਿੱਦਾਂ ਕਿ ਤੁਸੀਂ ਘਰ ਬੈਠੇ ਹੋ ਦੂਸਰਾ ਵਿਅਕਤੀ ਕਿਤੇ ਹੋਰ ਬੈਠਾ ਹੈ ਤਾਂ ਉਹ ਆਪਣੇ ਲੈਪਟਾਪ ਜਾਂ ਮੋਬਾਈਲ ਵਿੱਚ ਲਿੰਕ ਸ਼ੇਅਰ ਕਰਕੇ ਉਸ ਨੂੰ ਜੁਆਇਨ ਕਰ ਸਕਦਾ ਹੈ ਜੇ ਤੁਸੀਂ ਕਿਤੇ ਹੋਰ ਬੈਠੇ ਹੋ ਜਾਂ ਤੁਸੀਂ ਬਾਹਰ ਹੋ ਜਾਂ ਤੁਸੀਂ ਕਿਤੇ ਹੋਰ ਗਏ ਹੋ ਤਾਂ ਤੁਸੀ ਉਸ ਵੀਡੀਓ ਕਾਨਫਰੰਸਿੰਗ ਦੇ ਦੁਆਰਾ ਇੱਕ ਦੂਸਰੇ ਨਾਲ ਬਾਤਚੀਤ ਕਰ ਸਕਦੇ ਹੋ ਅਤੇ ਸਰਚ ਇੰਜਨ ਜਿਹੜਾ ਹੈ ਸਰਚ ਇੰਜਨ ਦੇ ਵਿੱਚ ਜਿੱਦਾਂ ਕਿ ਗੂਗਲ ਹੋ ਗਿਆ ਗੂਗਲ ਦੇ ਵਿੱਚ ਅਸੀਂ ਬਹੁਤ ਕੁਛ ਸਰਚ ਕਰ ਸਕਦੇ ਹਾਂ ਸਾਨੂੰ ਉੱਥੇ ਹਰ ਇੱਕ ਚੀਜ਼ ਦੀ ਜਾਣਕਾਰੀ ਮਿਲ ਸਕਦੀ ਹੈ ਜਿੱਦਾਂ ਕਿ ਤੁਸੀਂ ਆਪਣੇ ਕੰਮ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਹਾਨੂੰ ਉੱਥੇ ਮਿਲ ਸਕਦੀ ਹੈ ਤੇ ਅਤੇ ਜੇ ਤੁਸੀਂ ਕੋਈ ਖਾਣ ਪੀਣ ਦੀ ਜਾਣਕਾਰੀ ਲੈਣੀ ਹੈ ਜਾਂ ਕੋਈ ਕੰਪਨੀ ਕਿੱਦਾਂ ਸ਼ੁਰੂ ਕਰ ਸਕਦੇ ਹਾਂ ਅਸੀਂ ਬਿਜਨਸ ਕਿੱਦਾਂ ਸ਼ੁਰੂ ਕਰ ਸਕਦੇ ਹਾਂ ਉਹਦਾ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਗੂਗਲ ਤੋਂ ਮਿਲ ਸਕਦੀ ਹੈ ਜਿੱਦਾਂ ਕਿ ਇੱਕ ਜੂਮ ਮੀਟਿੰਗ ਐਪ ਹੈ ਜੂਮ ਮੀਟਿੰਗ ਐਪ ਜਿਹੜੀ ਹੈ ਉਹ ਬਹੁਤ ਹੀ ਲੰਬੇ ਸਮੇਂ ਤੱਕ ਅਸੀਂ ਵਰਤੋਂ ਕਰ ਸਕਦੇ ਹਾਂ ਜੇ ਉਹਦੇ ਵਿੱਚ ਵੀ ਇੱਕ ਦੂਸਰੇ ਨੂੰ ਅਸੀਂ ਵਟਸਐਪ ਦੇ ਥਰੂ ਲਿੰਕ ਸੈਂਡ ਕਰ ਸਕਦੇ ਹਾਂ ਅਤੇ ਇੱਕ ਦੂਸਰੇ ਇੱਕ ਦੂਸਰੀ ਥਾਵਾਂ 'ਤੇ ਬੈਠੇ ਲੋਕ ਉਸ ਲਿੰਕ ਨੂੰ ਆਪਣੇ ਨਾਮ ਤੋਂ ਜੁਆਇਨ ਕਰਕੇ ਅਤੇ ਮੀਟਿੰਗ ਸੁਣ ਸਕਦੇ ਹਨ ਅਤੇ ਉਹ ਘੰਟਾ ਦੋ ਘੰਟੇ ਤੱਕ ਮੀਟਿੰਗ ਚਲਦੀ ਰਹਿੰਦੀ ਹੈ ਅਤੇ ਆਧੁਨਿਕ ਸੰਸਾਰ ਵਿੱਚ ਬਹੁਤ ਹੀ ਸਾਰੀਆਂ ਤਕਨੀਕਾਂ ਹਨ ਜਿਹਨਾਂ ਕਰਕੇ ਵੱਡੀ ਵੱਡੀ ਕੰਪਨੀਆਂ ਅਤੇ ਬਿਜ਼ਨਸਾਂ ਨੂੰ ਬਹੁਤ ਹੀ ਫਾਇਦੇ ਹਨ ਧੰਨਵਾਦ